ਪੰਜਾਬ ਵਿੱਚ ਮੁੱਖ ਸਿਹਤ ਸੰਭਾਲ ਸਰਕਾਰ ਵੱਲੋਂ ਫੀਸ ਘੱਟ ਲਈ ਜਾਂਦੀ ਹੈ ਅਤੇ ਸੰਭਾਲ ਵੀ ਘੱਟ ਹੁੰਦੀ ਹੈ ਪ੍ਰਾਈਵੇਟ ਵੱਲੋਂ ਫੀਸ ਜ਼ਿਆਦਾ ਲਈ ਜਾਂਦੀ ਹੈ ਅਤੇ ਸੰਭਾਲ ਜ਼ਿਆਦਾ ਹੁੰਦੀ ਹੈ ਸਰਕਾਰੀ ਕੰਮ ਵਿੱਚ ਦੇਖਭਾਲ ਘੱਟ ਕਰਦੇ ਆ ਪ੍ਰਾਈਵੇਟ ਵਾਲੇ ਜੇ ਪੈਸੇ ਜ਼ਿਆਦਾ ਲੈਂਦੇ ਆ ਤਾਂ ਸੰਭਾਲ ਵੀ ਵਧੀਆ ਕਰਦੇ ਆ ਮਰੀਜ਼ ਦੀ ਅਤੇ ਐਨਜੀਓ ਵੱਲੋਂ ਅਨਮੋਲ ਕੁਆਤਰੇ ਨੇ ਲੁਧਿਆਣੇ 'ਚ ਐਨਜੀਓ ਸ਼ੁਰੂ ਕੀਤੀ ਹੈ ਜੇ ਕਿਸੇ ਕੋਲ ਇਲਾਜ ਕਰਵਾਉਣ ਨੂੰ ਪੈਸੇ ਨਹੀਂ ਹੈਗੇ ਉਹ ਐਨਜੀਓ ਵੱਲੋਂ ਉਹਦਾ ਫਰੀ ਇਲਾਜ ਕੀਤਾ ਜਾਂਦਾ ਐਨਜੀਓ ਵੱਲੋਂ ਅਨਮੋਲ ਕੁਆਤਰੇ ਨੇ ਜਿਹੜੀ ਸ਼ੁਰੂ ਕੀਤੀ ਹੈ ਜਿਹੜੀ ਜਿੱਡੀ ਬੜੀ ਮਰਜ਼ੀ ਬਿਮਾਰੀ ਹੋਵੇ ਉਹਦਾ ਇਲਾਜ ਐਨਜੀਓ ਵੱਲੋਂ ਫਰੀ ਕੀਤਾ ਜਾਂਦਾ ਹੁਣ ਪ੍ਰਾਈਵੇਟ ਹੋਸਪਿਟਲ ਹੈ ਉਹ ਸਹੂਲਤਾਂ ਜ਼ਿਆਦਾ ਮਿਲਦੀਆਂ ਆਪਾਂ ਨੂੰ ਫਿਰ ਸੰਭਾਲ ਵੀ ਵਧੀਆ ਤਰੀਕੇ ਨਾਲ ਕਰਦੇ ਸਰਕਾਰੀ ਵਾਲੇ ਸੰਭਾਲ ਨਹੀਂ ਕਰਦੇ ਫੀਸ ਘੱਟ ਹੁੰਦੀ ਹੈ ਸੰਭਾਲ ਉਹਨਾਂ ਨੇ ਕਰਨੀ ਨਹੀਂ ਕੋਈ ਮਰੀਜ਼ ਜਿੱਥੇ ਪਿਆ ਉੱਥੇ ਪਿਆ ਰਹੇ ਪ੍ਰਾਈਵੇਟ ਵਾਲੇ ਬਹੁਤ ਵਾਲੇ ਜੇ ਫੀਸ ਜ਼ਿਆਦਾ ਲੈਂਦੇ ਮਰੀਜ਼ ਦੀ ਸੰਭਾਲ ਵੀ ਵਧੀਆ ਤਰੀਕੇ ਨਾਲ ਕਰਦੇ ਆ ਅਤੇ ਮਰੀਜ਼ ਦਾ ਸਰਕਾਰੀ ਵੱਲੋਂ ਵੀ ਜੇ ਮਰੀਜ਼ ਦਾ ਆਪਰੇਸ਼ਨ ਕੀਤਾ ਜਾਂਦਾ ਉਹਦਾ ਉਹ ਵੀ ਸੰਭਾਲ ਡਾਕਟਰ ਉਹਨੂੰ ਦੇਖਦਾ ਨਹੀਂ ਹੈਗਾ ਵੇ ਮਰੀਜ਼ ਠੀਕ ਹੈਗਾ ਕਿ ਨਹੀਂ ਹੈਗਾ ਪ੍ਰਾਈਵੇਟ ਵਾਲੇ ਜੇ ਪੈਸੇ ਜ਼ਿਆਦਾ ਲੈ ਲੱਖਾਂ 'ਚ ਪੈਸੇ ਲੈਂਦੇ ਆ ਤੇ ਮਰੀਜ਼ ਦੀ ਸੰਭਾਲ ਵੀ ਵਧੀਆ ਤਰੀਕੇ ਨਾਲ ਕਰਦੇ ਆ ਡਾਕਟਰ ਆ ਕੇ ਬਾਰ ਬਾਰ ਗੇੜੇ ਮਾਰਦਾ ਦਿਨ 'ਚ ਤਿੰਨ ਚਾਰ ਵਾਰੀ ਜਾ ਕੇ ਮਰੀਜ਼ ਦਾ ਹਾਲ ਚਾਲ ਪੁੱਛਦਾ ਕਿ ਮਰੀਜ਼ ਕਿੱਦਾਂ ਠੀਕ ਹੈ ਕਿੱਦਾਂ ਹਾਲ ਅੱਗੇ ਨਾਲੋਂ ਠੀਕ ਆ ਤੁਸੀਂ ਦਰਦ ਦੂਰ ਦਰਦ ਤੁਹਾਡੇ ਦਾ ਘੱਟ ਹੁੰਦਾ ਕਿੱਦਾਂ ਹੁੰਦਾ ਸਰਕਾਰੀ ਵਾਲੇ ਜੇ ਆਪਰੇਸ਼ਨ ਅਪਰੇਸ਼ਨ ਅਬਲ ਤਾਂ ਆਪਰੇਸ਼ਨ ਕਰਦੇ ਨਹੀਂ ਜੇ ਕਰ ਵੀ ਦਿੰਦੇ ਆ ਤਾਂ ਮਰੀਜ਼ ਦੀ ਸੰਭਾਲ ਦੇਖਣੀ ਉਹਨਾਂ ਨੇ ਮਰੀਜ਼ ਹੈਗਾ ਕਿ ਨਹੀਂ ਹੈਗਾ ਬਈ ਨਾ ਉਹਨਾਂ ਨੇ ਪੁੱਛਣਾ ਵੀ ਸਰਕਾਰੀ ਨਰਸਾਂ ਵੀ ਇੱਦਾਂ ਦੀਆਂ ਉਹਨਾਂ ਨੇ ਵੀ ਨਹੀਂ ਆ ਕੇ ਮਰੀਜ਼ ਦਾ ਹਾਲ ਚਾਲ ਪੁੱਛਣਾ ਕਿ ਮਰੀਜ਼ ਕਿੱਦਾਂ ਮਰੀਜ਼ ਹੈਗਾ ਕਿ ਨਹੀਂ ਹੈਗਾ ਪ੍ਰਾਈਵੇਟ ਜੇ ਫੀਸ ਜ਼ਿਆਦਾ ਲੈਂਦੇ ਆ ਨਰਸਾਂ ਵੀ ਆ ਕੇ ਬਾਰ ਬਾਰ ਬੀਪੀ ਚੈੱਕ ਕਰਦੀਆਂ ਸਭ ਕੁਝ ਚੈੱਕ ਕਰਦੀਆਂ ਉਹਨਾਂ ਦਾ ਮਰੀਜ਼ ਦਾ ਕਿ ਤੁਸੀਂ ਏ ਠੀਕ ਆ ਅੱਗੇ ਨਾਲੋਂ ਪੇਨ ਘੱਟ ਹੁੰਦੀ ਹੈ ਅਪਰੇਟ ਹੋਇਆ ਹੁੰਦਾ ਉਹਦਾ ਅਪਰੇਸ਼ਨ ਜੇ ਅਗਲੇ ਅਪਰੇਸ਼ਨ ਕਰਦੇ ਤਾਂ ਨਰਸਾਂ ਬਾਰ ਬਾਰ ਆ ਕੇ ਬੀਪੀ ਚੈੱਕ ਕਰਦੀਆਂ ਅਤੇ ਮਰੀਜ਼ ਦਾ ਹਾਲ ਚਾਲ ਪੁੱਛਦੀਆਂ ਕਿ ਤੁਸੀਂ ਹੁਣ ਠੀਕ ਹੈ ਅੱਗੇ ਨਾਲੋਂ ਅੱਗੇ ਨਾਲੋਂ ਕਿਤੇ ਵਧੀਆ ਫੀਲ ਹੁੰਦਾ ਕਿੱਦਾਂ ਫੀਲ ਹੁੰਦਾ ਪੇਨ ਘਟੀ ਹੈ ਕਿ ਨਹੀਂ ਘਟੀ ਸਰਕਾਰੀ ਵਾਲੇ ਜੇ ਇਕ ਵਾਰ ਟੀਕਾ ਲਾ ਦਿੰਦੇ ਆ ਜੇ ਪਹਿਲਾਂ ਤਾਂ ਸਾਨੂੰ ਟੀਕਾ ਲਾਣਾ ਹੀ ਨਹੀਂ ਆ ਕੇ ਨਰਸਾਂ ਨੇ ਜੇ ਡਾਕਟਰ ਨੇ ਕਹਿ ਤਾ ਟੀਕਾ ਲਾਓ ਨਰਸਾਂ ਬੋਲਦੀਆਂ ਬੋ ਢੰਗ ਤਰੀਕਾ ਵਧੀਆ ਨਹੀਂ ਬੋਲਣ ਦਾ ਨਰਸਾਂ ਦਾ ਵੀ ਕਿੱਦਾਂ ਮਰੀਜ਼ ਨਾਲ ਗੱਲ ਕਰਨੀ ਆ ਮਰੀਜ਼ ਨਾਲ ਕਿੱਦਾਂ ਨਹੀਂ ਗੱਲ ਕਰਨੀ ਵੀ ਟੁੱਟ ਟੁੱਟ ਪੈਂਦੀਆਂ ਉਹ ਮਰੀਜ਼ ਨੂੰ ਜੇ ਕਵੇ ਜੀ ਸਾਡੇ ਮਰੀਜ਼ ਦੇ ਦਰਦ ਹੁੰਦਾ ਵੀ ਟੀਕਾ ਲਾ ਦਉ ਦਸ ਵਾਰੀ ਜਾ ਕੇ ਕਹਿਣਾ ਪੈਂਦਾ ਫਿਰ ਜਾ ਕੇ ਸਰਕਾਰੀ ਨਰਸਾਂ ਜਿਹੜੀਆਂ ਉਹ ਜਾ ਕੇ ਮਰੀਜ਼ ਦੇ ਟੀਕਾ ਲਾਉਂਦੀਆਂ ਪ੍ਰਾਈਵੇਟ ਵਾਲੇ ਜੇ ਇੱਕ ਵਾਰ ਜਾ ਕੇ ਕਹੋ ਨਰਸ ਨੂੰ ਵੀ ਦਰਦ ਹੁੰਦਾ ਉਸੇ ਟਾਈਮ ਆ ਕੇ ਟੀਕਾ ਲਾਉਂਦੀ ਜੇ ਪੈਸੇ ਜ਼ਿਆਦਾ ਲੈਂਦੇ ਆ ਸਰ ਪ੍ਰਾਈਵੇਟ ਵਾਲੇ ਅਤੇ ਮਰੀਜ਼ ਦੀ ਸੰਭਾਲ ਵੀ ਵਧੀਆ ਕਰ ਰਹੇ ਜਿਹੜੀ ਐਨਜੀਓ ਵੱਲੋਂ ਆ ਰਾਜੇ ਅਨਮੋਲ ਕਵਾਤਰੇ ਨੇ ਸ਼ੁਰੂ ਕੀਤਾ ਉਹਦਾ ਸਾਰਾ ਐਨ ਜਿਹੜੀ ਜਿੱਡੀ ਬੜੀ ਮਰਜ਼ੀ ਬਿਮਾਰੀ ਹੋਵੇ ਉਹਦਾ ਅਨਮੋਲ ਕਵਾਤਰੇ ਵੱਲੋਂ ਅਨਮੋਲ ਕਵਾਤਰੇ ਨੇ ਐਨਜੀਓ ਸ਼ੁਰੂ ਕੀਤੀ ਉਹਦਾ ਸਾਰਾ ਇਲਾਜ ਫਰੀ ਕੀਤਾ ਜਾਂਦਾ ਜਿੱਡੀ ਮ ਬੜੀ ਮਰਜ਼ੀ ਬਿਮਾਰੀ ਹੋਵੇ ਸਾਰਾ ਐਨਜੀਓ ਵੱਲੋਂ ਖਰਚਾ ਹੁੰਦਾ ਉਹਦਾ ਹੁਣ ਆ ਅਸੀਂ ਦੇਖਦੇ ਹਾਂ ਐਨਜੀਓ ਵੱਲੋਂ ਅਨਮੋਲ ਕਵਾਤਰੇ ਕੋਲ ਕਿੰਨੇ ਮਰੀਜ਼ ਆਉਂਦੇ ਲੱਖਾਂ ਹੀ ਮਰੀਜ਼ ਆਂਦੇ ਇੰਨੇ ਮਰੀਜ਼ ਆਂਦੇ ਆ ਉਹ ਦੇਖਦਾ ਵੀ ਕਿਸੇ ਨੂੰ ਕੋਈ ਵੀ ਬਿਮਾਰੀ ਹੁੰਦੀ ਆ ਉਹਦਾ ਐਨਜੀਓ ਵੱਲੋਂ ਸਾਰਾ ਖਰਚਾ ਫਰੀ ਕੀਤਾ ਜਾਂਦਾ ਸਾਰਾ ਖਰਚਾ ਏ ਟੂ ਜੈਡ ਤੋਂ ਲੈ ਕੇ ਸਾਰਾ ਖ ਖਰਚਾ ਉਹਦਾ ਫਰੀ ਹੈ ਜਿੱਡੀ ਵੱਡੀ ਮਰਜ਼ੀ ਬਿਮਾਰੀ ਹੋਵੇ ਉਹਦਾ ਸਾਰਾ ਖਰਚਾ ਐਨਜੀਓ ਵੱਲੋਂ ਐਨਜੀਓ ਚੱਕਦੀ ਉਹਦਾ ਸਾਰਾ ਖਰਚਾ ਏ ਟੂ ਜੈਡ ਬ ਸਰਕਾਰੀ ਵਾਲੇ ਕੋਈ ਸ ਸੰਭਾਲ ਨਹੀਂ ਹੈਗੀ ਜੇ ਫੀਸ ਘੱਟ ਲੈਂਦੇ ਆ ਤਾਂ ਸੰਭਾਲ ਵੀ ਨਹੀਂ ਕੋਈ ਮਰੀਜ਼ ਦੀ ਹੈਗੀ ਜਿੱਥੇ ਪਿਆ ਮਰੀਜ਼ ਉੱਥੇ ਪਿਆ ਰਹੇ ਕੋਈ ਇਹਨੂੰ ਦੇਖਣਾ ਨਹੀਂ ਕੋਈ ਨਹੀਂ ਦੇਖਣਾ ਜੇ ਪ੍ਰਾਈਵੇਟ ਵਾਲੇ ਵਧੀਆ ਤਰੀਕੇ ਨਾਲ ਇਲਾਜ ਕਰਦੇ ਅਤੇ ਪੈਸੇ ਵਧੀਆ ਰਹਿੰਦੇ ਅਤੇ ਇਲਾਜ ਵੀ ਵਧੀਆ ਤਰੀਕੇ ਨਾਲ ਕਰਦੇ ਬਾਰ ਬਾਰ ਆ ਕੇ ਹਾਲ ਪੁੱਛਦੇ ਡਾਕਟਰ ਪੁੱਛਦੇ ਆ ਕੇ ਹਾਲ ਮਰੀਜ਼ ਦਾ ਕਿ ਤੁਸੀਂ ਠੀਕ ਆ ਅੱਗੇ ਨਾਲੋਂ ਕਿ ਨਹੀਂ ਜੇ ਕੋਈ ਵੀ ਪ੍ਰੋਬਲਮ ਹੁੰਦੀ ਹੈ ਅਗਲੇ ਇਸੇ ਟਾਈਮ ਕਹਿੰਦੇ ਲਾਓ ਇੰਜੈਕਸ਼ਨ ਇਹਨਾਂ ਦੇ ਕੋਈ ਪ੍ਰੋਬਲਮ ਹੁੰਦੀ ਉਸੇ ਟਾਈਮ ਡਾਕਟਰ ਕਹਿੰਦਾ ਨਰਸ ਨੂੰ ਦੇਖੋ ਇਹਨੂੰ ਕੀ ਪ੍ਰੋਬਲਮ ਹੈ ਸਰਕਾਰੀ ਵਾਲੇ 'ਚ ਕੋਈ ਸਹੂਲਤ ਨਹੀਂ ਹੈਗੀ ਜੇ ਪੈਸੇ ਨਹੀਂ ਲੈਂਦੇ ਉਹ ਘੱਟ ਪੈਸੇ ਲੈਂਦੇ ਆ ਤੇ ਸਹੂਲਤ ਵੀ ਨਹੀਂ ਹੈਗੀ ਕੋਈ ਬਿਲਕੁਲ ਸਹੂਲਤ ਨਹੀਂ ਹੈਗੀ ਸਰਕਾਰੀ ਦੀ